ਹੈਲੋ ਤੁਸੀਂ ਕੋਮਲ ਆਟੋ ਰਿਕਸ਼ਾ ਬੋਲ ਰਹੇ ਹੋ ਠੀਕ ਹੈ ਮੈਮ ਅਸੀਂ ਮਤਲਬ ਘੋੜਿਆਂ ਲਈ ਜਾਣਾ ਸੀ ਕੱਲ੍ਹ ਅਸੀਂ ਕੱਲ੍ਹ ਸਵੇਰੇ ਸਵੇਰੇ ਜਾਣਾ ਆ ਸਾਨੂੰ ਮਤਲਬ ਨੌਂ ਵਜੇ ਤੱਕ ਤੁਸੀਂ ਪਹੁੰਚਾ ਸਕਦੇ ਹੋ ਅ ਸਾ ਅਸੀਂ ਪੰਜ ਜਣੇ ਹਾਂ ਠੀਕ ਹੈ ਤੁਸੀਂ ਕਰਾਇਆ ਕੀ ਲੈਂਦੇ ਹੋ ਇੱਕ ਬੰਦੇ ਦਾ ਠੀਕ ਹੈ ਥੋੜ੍ਹਾ ਲੈਸ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਫਿਰ ਮਤਲਬ ਨਵੀਂ ਅਬਾਦੀ ਕੱਲ੍ਹ ਸੱਤ ਵਜੇ ਤੱਕ ਇੱਥੇ ਆ ਸਕਦੇ ਹੋ ਉਹ ਅਸੀਂ ਮਤਲਬ ਮੇਰੀ ਫਰੈਂਡ ਇੱਕ ਹੈਗੀ ਹੈ ਥੋੜ੍ਹੇ ਅੱਗੇ ਮਤਲਬ ਅਗਲੇ ਪਿੰਡ ਤੋਂ ਜਾਣਾ ਹੈ ਠੀਕ ਹੈ ਤੁਹਾਡੀ ਆਟੋ 'ਚ ਮਤਲਬ ਪੂਰੀ ਸੇਫ ਸੇਫ ਰਾਈਡਿੰਗ ਹੈ ਨਾ ਠੀਕ ਹੈ ਮੈਮ ਅਤੇ ਤੁਹਾਡੀ ਆਟੋ 'ਚ ਪੰਜ ਬੰਦੇ ਬੈਠਣ ਮਤਲਬ ਆਰਾਮ ਨਾਲ ਬੈਠ ਸਕਦੇ ਹੈ ਨਾ ਲੈਂ ਠੀਕ ਹੈ ਅਤੇ ਸਾਡੇ ਕੋਲੋਂ ਮਤਲਬ ਆਪ ਖੁਦ ਕੋਲ ਸਮਾਨ ਵੀ ਹੈਗਾ ਜਿਵੇਂ ਵਗੈਰਾ ਹੈਗੇ ਨੇ ਅਤੇ ਉਹਨਾਂ ਨੂੰ ਰੱਖਣਾ ਅਤੇ ਉੱਪਰ ਆਟੋ ਦੇ ਸਟੈਂਡ ਹੋਵੇਗਾ ਠੀਕ ਹੈ ਸਾਡੀ ਸਾਰੀ ਮੰਨ ਲਿਓ ਤੁਸੀਂ ਆਟੋ ਉੱਥੇ ਦੋ ਘੰਟੇ ਸਾਡੀ ਵੇਟ ਕਰ ਸਕਦੀ ਹੈ ਸਾਨੂੰ ਦੋ ਤਿੰਨ ਘੰਟੇ ਵੇਟ ਕਰਕੇ ਅਤੇ ਉੱਥੋਂ ਕੁਛ ਬੱਚਿਆਂ ਨੇ ਵਾਪਸ ਵੀ ਆਣਾ ਅਤੇ ਉਹਨਾਂ ਨੂੰ ਵਾਪਿਸ ਲਿਆਉਣ ਦਾ ਮਤਲਬ ਕੀ ਪ੍ਰਾਇਸ ਹੈ ਅਤੇ ਉੱਥੇ ਵੇਟ ਕਰ ਲਵੋਗੇ ਓਕੇ ਮੈਡਮ ਤੁਸੀਂ ਮਤਲਬ ਆਪਣੇ ਆਨਲਾਈਨ ਵੀ ਜਦੋਂ ਉਹ ਲੋੜ ਪਵੇ ਤਾਂ ਤੁਸੀਂ ਆਪਣਾ ਨੰਬਰ ਸਾਨੂੰ ਦੱਸ ਸਕਦੇ ਹੋ ਅਸੀਂ ਫੋਨ ਕਰਕੇ ਤੁਹਾਨੂੰ ਬੁਲਾ ਲਾਂਗੇ ਓਕੇ ਮੈਮ ਤੁਹਾਡੀ ਮਤਲਬ ਕਿ ਆਟੋ ਸਰਵਿਸ ਇਹ ਰਾਤ ਨੂੰ ਵੀ ਅਸੀਂ ਕਿਸੇ ਵੀ ਟਾਈਮ ਮਤਲਬ ਬੁਲਾ ਸਕਦੇ ਹਾਂ ਤਾਂ ਤੁਸੀਂ ਆ ਸਕਦੇ ਹੋ ਠੀਕ ਹੈ ਅਤੇ ਤੁਹਾਡੇ ਜਿਹੜੇ ਡਰਾਈਵਰ ਰੱਖੇ ਹੋਏ ਆ ਤੁਸੀਂ ਉਹ ਉਹਨਾਂ ਦੀ ਏਜ ਏਟੀਟਿਨ ਪਲੱਸ ਹੀ ਹੈ ਨਾ ਠੀਕ ਹੈ ਠੀਕ ਹੈ ਮੈਮ ਹਾਂਜੀ ਮੈਮ ਕੋਈ ਨਾ